ਪੰਜਾਬੀ ਭਾਸ਼ਾ ਨੇ ਸਾਡੇ ਸੱਭਿਆਚਾਰ ਅਤੇ ਪਛਾਣ ਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕੀਤਾ ਕਿਉਂਕਿ ਪੰਜਾਬ ਦੇ ਲੋਕ ਪੰਜਾਬੀ ਬੋਲਦੇ ਹਨ ਅਤੇ ਆਪਸ ਵਿੱਚ ਬਹੁਤ ਹੀ ਜ਼ਿਆਦਾ ਪੰਜਾਬੀ ਵਿੱਚ ਆ ਇੱਕ ਦੂਜੇ ਨੂੰ ਸਤਿਕਾਰ ਨਾਲ ਬੁਲਾਉਂਦੇ ਹਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਪੰਜਾਬੀ ਬੁਲਾਈ ਜਾਂਦੀ ਹੈ ਜੋ ਕਿ ਬੁਲਾਉਣੀ ਵੀ ਚਾਹੀਦੀ ਹੈ ਪ੍ਰਾਈਵੇਟ ਸਕੂਲਾਂ ਵਿੱਚ ਇਹ ਜ਼ਰੂਰੀ ਨਹੀਂ ਹੈ ਗੀ ਉੱਥੇ ਇੰਗਲਿਸ਼ ਮੀਡੀਅਮ ਕਰ ਦਿੱਤਾ ਉੱਥੋਂ ਦੇ ਬੱਚਿਆਂ ਨੂੰ ਵੀ ਪੰਜਾਬੀ ਬੋਲਣੀ ਚਾਹੀਦੀ ਆ ਕਿਉਂਕਿ ਉਹ ਵੀ ਪੰਜਾਬ ਦੇ ਹੀ ਵਿੱ ਪੰਜਾਬ ਵਿੱਚ ਹੀ ਰਹਿੰਦੇ ਹਨ ਅਤੇ ਉਹਨਾਂ ਨੂੰ ਵੀ ਪੰਜਾਬੀ ਬੋਲਣੀ ਸਿਖਾਉਣੀ ਚਾਹੀਦੀ ਆ ਅਤੇ ਪ੍ਰਾਈਵੇਟ ਸਕੂਲ ਵਾਲੇ ਇਹ ਉਹ ਨਹੀਂ ਕਰਵਾਉਂਦੇ ਉੱਥੇ

ਇੱਕ ਦੂਜੇ ਜੇਕਰ ਕੋਈ ਵ ਆ ਆਪਣੇ ਤੋਂ ਵੱਡਾ ਹੋਵੇ ਜਾਂ ਬੱਚੇ ਕਿਸੇ ਆਪਣੇ ਵੱਡੇ ਨੂੰ ਬੁਲਾਵੇ ਤਾਂ ਬਾਈ ਜੀ ਜਾਂ ਦਾਦਾ ਦਾਦੀ ਕੁਛ ਵੀ ਬਹੁਤ ਹੀ ਜ਼ਿਆਦਾ ਜੀ ਨਾਲ ਅਤੇ ਸਤਿਕਾਰ ਨਾਲ ਬੁਲਾਉਂਦੇ ਹਨ ਜੋ ਕਿ ਪੰਜਾਬੀ ਭਾਸ਼ਾ ਵਿੱਚ ਹੁੰਦਾ ਹੈ